ਸਤਿ ਸ਼੍ਰੀ ਅਕਾਲ ਮੇਰਾ ਨਾਮ ਵਾਸੂਦਾ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਅਤੇ ਮੇਰੇ ਪਰਿਵਾਰ ਨੇ ਇੱਕ ਹਫਤੇ ਪਹਿਲਾਂ ਅੰਮ੍ਰਿਤਸਰ ਜਾਣ ਦਾ ਪਲੈਨ ਬਣਾਇਆ ਸੀ ਜੋ ਕਿ ਆਪਾਂ ਟ੍ਰੇਨ ਰਾਹੀਂ ਸਫ਼ਰ ਕੀਤਾ ਕਿਉਂਕਿ ਸਾਨੂੰ ਟਰੇ ਟ੍ਰੇਨ ਵਿੱਚ ਕਾਫ਼ੀ ਸੋਹਣੇ ਸੋਹਣੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ ਇਸ ਕਰਕੇ ਆਪਾਂ ਟ੍ਰੇਨ ਵਿੱਚ ਸਫ਼ਰ ਕਰਨਾ ਪਸੰਦ ਕੀਤਾ ਅਤੇ ਆਪਾਂ ਟ੍ਰੇਨ ਵਿੱਚ ਜਾਣ ਦੇ ਟਾਇਮ ਅੰਤਾਕਸ਼ਨੀ ਬਹੁਤ ਕੁਛ ਕੀਤਾ ਇੰਜੋਆਏ ਕੀਤਾ ਮੈਂ ਆਪਣੇ ਘਰਦਿਆਂ ਨਾਲ ਬਹੁਤ ਸਮਾਂ ਗੁਜ਼ਾਰਿਆ ਫਿਰ ਆਪਾਂ ਅੰਮ੍ਰਿਤਸਰ ਪੁੱਜੇ ਅੰਮ੍ਰਿਤਸਰ ਜਾ ਕੇ ਅਸੀਂ ਓਟੋ ਲਿਆ ਅਤੇ ਸ਼੍ਰੀ ਹਰਮੰਦਰ ਸਾਹਿਬ ਦੀ ਜਗ੍ਹਾ 'ਤੇ ਪੁੱਜੇ ਪਰ ਜਦੋਂ ਆਪਾਂ ਉੱਥੇ ਪੁੱਜੇ ਤਾਂ ਅਸੀਂ ਦੇਖਿਆ ਕਿ ਓਥੇ ਬੜੀ ਹੀ ਦੂਰ ਤੱਕ ਇੱਕ ਲੰਬੀ ਲਾਇਨ ਲੱਗੀ ਹੋਈ ਹੈ ਪਰ ਅਸੀਂ ਹਾਰ ਨਹੀਂ ਮੰਨੀ ਆਪਾਂ ਲਾਇਨ ਵਿੱਚ ਡਟੇ ਰਹੇ ਅਤੇ ਕਿੰਨੇ ਦੋ ਤਿੰਨ ਘੰਟੇ ਬਾਅਦ ਸਾਡੀ ਵਾਰੀ ਆਈ ਅਸੀਂ ਬਹੁਤ ਥੱਕ ਚੁੱਕੇ ਸੀ ਪਰ ਆਪਾਂ ਜਿੱਦਾਂ ਹੀ ਅੰਦਰ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਸਾਡੀ ਸਾਰੀ ਥਕਾਨ ਸਾਰਾ ਕੁਛ ਖਤਮ ਹੋ ਗਿਆ ਅਤੇ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਕੇ ਆਪਾਂ ਪਵਿੱਤਰ ਹੋ ਗਏ ਜੋ ਕਿ ਸਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਸੀ ਫਿਰ ਆਪਾਂ ਉਸ ਤੋਂ ਬਾਹਰ ਆਏ ਅਤੇ ਅਸੀਂ ਅਸੀਂ ਬਜ਼ਾਰ ਵਿੱਚ ਘੁੰਮੇ ਬਜ਼ਾਰ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਜਿਵੇਂ ਕਿ ਖਾਣ ਪੀਣ ਵਾਲੀਆਂ ਖਰੀਦਣ ਵਾਲੀਆਂ ਜਿਵੇਂ ਕਿ ਉੱਥੇ ਬਹੁਤ ਕੁਛ ਖਾਣ ਪੀਣ ਬਾਰੇ ਲੱਗਾ ਹੋਇਆ ਸੀ ਹੋਰ ਉੱਥੇ ਸੂਟ ਬੜੇ ਹੀ ਜ਼ਿਆਦਾ ਸਸਤੇ ਦਾਮ 'ਤੇ ਮਿਲਿਆ ਕਰਦੇ ਸੀ